ਸਤਿ ਸ਼੍ਰੀ ਅਕਾਲ ਜੀ ਮੈਨੂੰ ਸ਼ੁਰੂ ਤੋਂ ਹੀ ਖਾਣਾ ਬਣਾਉਣ ਦਾ ਬਹੁਤ ਸ਼ੌਕ ਸੀ ਅਤੇ ਮੈਂ ਹਮੇਸ਼ਾ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਦੇ ਤਰੀਕੇ ਸਿੱਖਦੀ ਰਹਿੰਦੀ ਹਾਂ ਮੈਨੂੰ ਅੱਜ ਵੀ ਯਾਦ ਹੈ ਮੈਂ ਸਭ ਤੋਂ ਪਹਿਲਾ ਆਪਣਾ ਜੋ ਖਾਣਾ ਬਣਾਉਣਾ ਆਪਣੀ ਮਾਤਾ ਤੋਂ ਸਿੱਖ ਮਾਤਾ ਜੀ ਤੋਂ ਸਿੱਖਿਆ ਸੀ ਅਤੇ ਮੈਂ ਉਸ ਉਸ ਉਸ ਸਮੇਂ ਮੇਰੀ ਉਮਰ ਦਸ ਪੰਦਰਾਂ ਸਾਲ ਦੀ ਸੀ ਜਦੋਂ ਮੈਂ ਆਪਣਾ ਕਿ ਖਾਣਾ ਬਣਾਉਣਾ ਸ਼ੁਰੂ ਕੀਤਾ ਸੀ ਅਤੇ ਆਪਣੀ ਪਹਿਲੀ ਵਾਰ ਰਸੋਈ ਵਿੱਚ ਕੁਛ ਨਵੀਂ ਚੀਜ਼ ਬਣਾਈ ਸੀ ਮੈਂ ਸਭ ਤੋਂ ਪਹਿਲਾਂ ਜੋ ਰਸੋਈ ਵਿੱਚ ਬਣਾਇਆ ਸੀ ਉਹ ਖੀਰ ਬਣਾਈ ਸੀ ਉਸ ਸਮੇਂ ਮੇਰੀ ਮਾਤਾ ਜੀ ਮੇਰੇ ਲਾਗੇ ਖੜ੍ਹੇ ਸਨ ਅਤੇ ਮੈਨੂੰ ਦੱਸਦੇ ਗਏ ਕਿ ਪਹਿਲਾਂ ਕੀ ਕਰਨਾ ਹੈ ਅਤੇ ਬਾਅਦ ਵਿੱਚ ਕੀ ਕਰਨਾ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਸਭ ਤੋਂ ਵੱਡੀ ਗੱਲ ਖਾਣੇ ਬਣਾਉਣ ਵਿੱਚ ਜਦੋਂ ਆਪਾਂ ਪਿਆਰ ਨਾਲ ਖਾਣਾ ਬਣਾਉਂਦੇ ਹਾਂ ਤਾਂ ਉਹ ਵਧੀਆ ਹੁੰਦੀ ਹੈ ਉਸ ਨਾਲ ਖਾਣਾ ਹੋਰ ਵੀ ਵਧੀਆ ਬਣਦਾ ਹੈ ਉਹਨਾਂ ਨੇ ਮੈਨੂੰ ਦੱਸਿਆ ਕਿ ਖੀਰ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਚੌਲ ਲੈਂਦੇ ਹਾਂ ਦੁੱਧ ਲੈਂਦੇ ਹਾਂ ਖੰਡ ਲੈਂਦੇ ਹਾਂ ਕਾਜੂ ਬਦਾਮ ਜੋ ਵੀ ਅਸੀਂ ਉਸ ਵਿੱਚ ਪਾਉਣਾ ਚਾਹੁੰਦੇ ਹਾਂ ਅਸੀਂ ਉਹ ਲੈਂਦੇ ਹਾਂ ਉਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਚੌਲਾਂ ਨੂੰ ਧੋਂਦੇ ਹਾਂ ਫਿਰ ਉਹਨਾਂ ਨੂੰ ਉਬਾਲਦੇ ਹਾਂ ਫਿਰ ਉਸ ਦੇ ਵਿੱਚ ਅਸੀਂ ਆਪਾਂ ਦੁੱਧ ਨੂੰ ਪਾਉਂਦੇ ਹਾਂ ਅਤੇ ਉਹਨੂੰ ਦੁੱਧ ਨੂੰ ਸੁੱਕਣ ਤੱਕ ਉਸਨੂੰ ਧੀਮੀ ਅੱਗ 'ਤੇ ਰੱਖਦੇ ਹਾਂ ਅਤੇ ਜਦੋਂ ਪੱਕ ਜਾਂਦੇ ਹੈ ਤਾਂ ਬਾਅਦ ਵਿੱਚ ਅਸੀਂ ਉਸ ਦੇ ਵਿੱਚ ਬਦਾਮ ਕਾਜੂ ਜੋ ਵੀ ਅਸੀਂ ਇਲਾਚੀ ਪਾਉਣਾ ਚਾਹੁੰਦੇ ਹਾਂ ਅਸੀਂ ਪਾਉਂਦੇ ਹਾਂ ਅਤੇ ਇਹ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਘਰਦਿਆਂ ਵਾਸਤੇ ਕੁਛ ਬਣਾਇਆ ਸੀ ਅਤੇ ਜੋ ਬਹੁਤ ਹੀ ਵਧੀਆ ਬਣਿਆ ਸੀ ਅਤੇ ਇਸ ਤਰ੍ਹਾਂ ਹੀ ਮੈਂ ਹੌਲੀ ਹੌਲੀ ਆਪਣੀ ਮਾਤਾ ਜੀ ਤੋਂ ਆਪਣੀ ਹਰ ਚੀਜ਼ ਬਾਰੇ ਸਿੱਖਿਆ ਸਬਜ਼ੀ ਬਣਾਉਣਾ ਰੋਟੀ ਬਣਾਉਣਾ ਅਤੇ ਅੱਜ ਅਤੇ ਉਹਨਾਂ ਤੋਂ ਹਰ ਅਤੇ ਉਹਨੂੰ ਹੋਰ ਵੀ ਸਵਾਦ ਨੂੰ ਨਿਖਾਰਨ ਵਾਸਤੇ ਅਲੱਗ ਅਲੱਗ ਤਰੀਕੇ ਵੀ ਸਿੱਖੇ ਅਤੇ ਇਹੀ ਮੇਰਾ ਅਤੇ ਉਹਨਾਂ ਤੋਂ ਮੈਂ ਹੋਰ ਵੀ ਵਧੀਆ ਵਧੀਆ ਡਿੱਸ਼ਾਂ ਔਨਲਾਈਨ ਵੀ ਬਹੁਤ ਕੁਝ ਸਿੱਖਿਆ ਵਧੀਆ ਵਧੀਆ ਤਰੀਕੇ ਨਾਲ ਚੀਜ਼ਾਂ ਬਣਾਉਣਾ ਅਤੇ ਹੋਰ ਸੌਖੇ ਤਰੀਕੇ ਦੇ ਨਾਲ ਚੀਜ਼ਾਂ ਬਣਾਉਣਾ ਸਿੱਖਿਆ ਧੰਨਵਾਦ ਜੀ